ਹਾਈਕਿੰਗ ਕਰਨ ਲਈ ਮੁਢਲੀ ਸਿੱਖਿਆ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕੀ ਇਹ ਤਜਰਬੇ ਦੇ ਨਾਲ ਨਹੀਂ ਆਉਂਦਾ ਤਜਰਬਾ ਵੀ ਤਾਂ ਹੀ ਹੁੰਦਾ ਹੈ ਕੁੱਛ ਸਿੱਖਿਆ ਹੋਵੇ ਸਿੱਖ ਸਿੱਖ ਕੇ ਹੀ ਤਜਰਬਾ ਆਉਂਦਾ ਇਸ ਲਈ ਮੁੱਢਲੀ ਸਿੱਖਿਆ ਹਾਈਕਿੰਗ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਜਦੋਂ ਮੈਂ ਆਪਣੀ ਹਾਈਕਿੰਗ ਦੀ ਸ਼ੁਰੂਆਤ ਕੀਤੀ ਸੀ ਤਾਂ ਇੱਕ ਛੋਟੇ ਛੋਟੇ ਹਾਈਕਸ ਲਗਾਉਂਦਾ ਸੀਗਾ ਛੋਟੇ ਛੋਟੇ ਹਾਈਕਿੰਗ ਕਰਦਾ ਸੀਗਾ ਜਾਂ ਕੁਝ ਪੰਜ ਕਿਲੋਮੀਟਰ ਹੋ ਗਏ ਜਾਂ ਦਸ ਕਿਲੋਮੀਟਰ ਹੋ ਗਿਆ ਉਸ ਤੋਂ ਬਾਅਦ ਮੈਂ ਆਪਣੀ ਹਾਈਕਿੰਗ ਨੂੰ ਵਧਾਉਣਾ ਸ਼ੁਰੂ ਕੀਤਾ ਪੰਦਰ੍ਹਾਂ ਕਿਲੋਮੀਟਰ ਵੀਹ ਕਿਲੋਮੀਟਰ ਚਾਲੀ ਕਿਲੋਮੀਟਰ ਜਾਂ ਸੱਠ ਕਿਲੋਮੀਟਰ ਮੈਂ ਜ਼ਿਆਦਾ ਤੋਂ ਜ਼ਿਆਦਾ ਸੱਤਰ ਕਿਲੋਮੀਟਰ ਦੀ ਹਾਈਕਿੰਗ ਕੀਤੀ ਹੋਈ ਹੈ ਪਰ ਬਹੁਤ ਹੀ ਉਹ ਹਾਈਕਿੰਗ ਬਹੁਤ ਮੁਸ਼ਕਿਲ ਸੀ ਇਸ ਲਈ ਇਹਦੇ ਨਾਲ ਜਦੋਂ ਤੁਸੀਂ ਹਾਈਕਿੰਗ ਕਰਦੇ ਹੋ ਛੋਟੇ ਛੋਟੇ ਹਾਈਕਿੰਗ ਕਰਦੇ ਹੋ ਉਸ ਤੋਂ ਬਾਅਦ ਵੱਡੇ ਹਾਈਕਿੰਗ ਕਰਦੇ ਹੋ ਤਾਂ ਨਾਲ ਹੀ ਤੁਹਾਡਾ ਤਜਰਬਾ ਵੀ ਨਾਲ ਹੀ ਜੁੜਦਾ ਜਾਂਦਾ ਤਜਰਬੇ ਦੇ ਨਾਲ ਤੁਸੀਂ ਹੋਰ ਜ਼ਿਆਦਾ ਐਕਸਪਰਟ ਹੁੰਦੇ ਹੋ ਹੋਰ ਜ਼ਿਆਦਾ ਤੁਸੀਂ ਹਾਈਕਿੰਗ ਦੇ ਲਈ ਤੁਹਾਡੇ ਜਨੂੰਨ ਆਉਂਦਾ ਇਸ ਲਈ ਮੈਂ ਕਹਿਣਾ ਚਾਹੁੰਦਾ ਕਿ ਮੁਢਲੀ ਸਿੱਖਿਆ ਬਹੁਤ ਜ਼ਿਆਦਾ ਜ਼ਰੂਰੀ ਹੈ ਤਜਰਬੇ ਦੇ ਨਾਲ ਹਾਈਕਿੰਗ ਨਹੀਂ ਆਉਂਦੀ ਸਿੱਖ ਕੇ ਹੀ ਹਾਈਕਿੰਗ ਆਉਂਦੀ ਹੈ ਇਸ ਲਈ ਸਿੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਪੂਰੀ ਆਪਣੀ ਜ਼ਿੰਦਗੀ ਸਿੱਖਦੇ ਹੀ ਰਹਿਣਾ ਚਾਹੀਦਾ ਕੀ ਸਿੱਖ ਸਿੱਖ ਕੇ ਤੁਹਾਨੂੰ ਦੇ ਨਾਲ ਤਜਰਬਾ ਆਉਂਦਾ